ਪੇਂਡੂ ਖੇਤਰਾਂ ਵਿੱਚ ਰਿਸ਼ਤੇ ਕਰਨ ਵਿੱਚ ਪ੍ਰੋਬਲਮ ਕਦੇ ਆਉਂਦੀ ਹੁੰਦੀ ਸੀ ਲੇਕਿਨ ਹੁਣ ਤਾਂ ਅਜਿਹਾ ਕੁਛ ਨਹੀਂ ਪਹਿਲਾਂ ਰਿਸ਼ਤੇ ਹੁੰਦੇ ਸਨ ਵਿਚੋਲਿਆਂ ਰਾਹੀਂ ਜਿੰਨਾ ਕੁ ਉਹਨਾਂ ਦਾ ਦਾਇਰਾ ਹੁੰਦਾ ਸੀ ਉੱਥੋਂ ਹੀ ਆਪਣੇ ਜਾਣਦੇ ਹੋਏ ਲੋਕਾਂ ਦੇ ਆਪਸ ਵਿੱਚ ਰਿਸ਼ਤੇ ਕਰਵਾ ਦਿੰਦੇ ਸਨ ਲੇਕਿਨ ਹੁਣ ਅਜਿਹੀ ਗੱਲ ਨਹੀਂ ਮੈਟਰੀਮੋਨੀਅਲ ਸਾਈਟਸ ਵੀ ਬਹੁਤ ਹਨ ਨੈੱਟ ਦੇ ਥਰੂ ਵੀ ਤਾਂ ਰਿਸ਼ਤੇ ਲੱਭ ਜਾਂਦੇ ਹਨ ਵੈਸੇ ਇੱਕ ਇਹ ਗੱਲ ਵੱਖਰੀ ਹੈ ਕਿ ਨੌਜਵਾਨ ਲੜਕੇ ਵੀ ਸ਼ਹਿਰਾਂ ਵਿੱਚ ਹੀ ਜਾਣਾ ਚਾਹੁੰਦੇ ਆ ਔਰ ਨੌਜਵਾਨ ਲੜਕੀਆਂ ਵੀ ਸ਼ਹਿਰਾਂ ਵਿੱਚ ਹੀ ਆਪਣੇ ਰਿਸ਼ਤੇ ਕਰਵਾਉਣਾ ਚਾਹੁੰਦੇ ਆ ਕਿਉਂਕਿ ਨੌਕਰੀਆਂ ਦੇ ਚਾਂਸਿਸ ਜਿਹੜੇ ਆ ਉਹ ਜ਼ਿਆਦਾਤਰ ਸ਼ਹਿਰਾਂ ਵਿੱਚ ਆ ਅਤੇ ਪਿੰਡ ਸ਼ਹਿਰਾਂ ਦੀਆਂ ਕੁੜੀਆਂ ਪਿੰਡਾਂ ਵਿੱਚ ਆਉਣਾ ਪਸੰਦ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਉਹ ਸਹੂਲਤਾਂ ਪ੍ਰਾਪਤ ਨਹੀਂ ਹੁੰਦੀਆਂ ਜੋ ਉਹਨਾਂ ਨੂੰ ਸ਼ਹਿਰਾਂ ਵਿੱਚ ਪ੍ਰਾਪਤ ਹੁੰਦੀਆਂ ਹਨ ਇਸ ਕਰਕੇ ਇਹੋ ਕਾਰਨ ਆ ਕਿ ਪਿੰਡ ਪਿੰਡ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸ਼ਹਿਰਾਂ ਵਿੱਚ ਹੀ ਆਪਣੇ ਰਿਸ਼ਤੇ ਕਰਵਾਉਣੇ ਚਾਹੁੰਦੀ ਆ ਉੱਥੇ ਵੱਸਣਾ ਚਾਹੁੰਦੀ ਆ ਉੱਥੇ ਹੀ ਅੱਗੇ ਉਹਨਾਂ ਦੇ ਜਦੋਂ ਵਿਆਹ ਹੋ ਜਾਂਦੇ ਆ ਉਹਨਾਂ ਦੇ ਬੱਚਿਆਂ ਨੇ ਕਾਲਜਾਂ ਸਕੂਲਾਂ ਵਿੱਚ ਵੀ ਪੜ੍ਹਨਾ ਹੁੰਦਾ ਹੈ ਅਤੇ ਫਿਰ ਜੇ ਸ਼ਹਿਰਾਂ ਵਿੱਚ ਹੋਣਗੇ ਤਾਂ ਉਹਨਾਂ ਦੇ ਬੱਚਿਆਂ ਨੂੰ ਚੰਗੇ ਸਕੂਲ ਚੰਗੀ ਵਿੱਦਿਆ ਵੀ ਪ੍ਰਾਪਤ ਹੋ ਜਾਵੇਗੀ ਬਸ ਇਹੋ ਹੀ ਕੁਛ ਕਾਰਣ ਹਨ ਜਿੰਨ੍ਹਾਂ ਕਰਕੇ ਨੌਜਵਾਨ ਪੀੜ੍ਹੀ ਸ਼ਹਿਰਾਂ ਵਿੱਚ ਰਿਸ਼ਤੇ ਕਰਵਾਉਣਾ ਚਾਹੁੰਦੀ ਆ ਔਰ ਸ਼ਹਿਰਾਂ ਵਿੱਚ ਵੱਸਣਾ ਚਾਹੁੰਦੀ ਆ ਧੰਨਵਾਦ